ਜੇਕਰ ਦੇਖਿਆ ਜਾਵੇ ਭਾਰਤ ਦੀ ਆਜ਼ਾਦੀ ਦੀ ਲਹਿਰਾਂ ਬਾਰੇ ਤਾਂ ਬਹੁਤ ਲ਼ ਲਹਿਰਾਂ ਚੱਲੀਆਂ ਹਨ ਜਿੰਨਾਂ ਦੇ ਵਿੱਚੋਂ ਕੁਝ ਮਹੱਤਵਪੂਰਨ ਘਟਨਾਵਾਂ ਦਾ ਮੈਂ ਤੁਹਾਨੂੰ ਦੱਸ ਸਕਦਾ ਹਾਂ ਜਿਵੇਂ ਭਾਰਤ ਛੱਡੋ ਪੱਗੜੀ ਸੰਭਾਲ ਜੱਟਾ ਓਏ ਬੱਬਰ ਅਕਾਲੀ ਲਹਿਰ ਅਤੇ ਹੋਰ ਵੀ ਅਨੇਕਾਂ ਹੀ ਇੱਦਾਂ ਦੀਆਂ ਜਿਹੜੀਆਂ ਲਹਿਰਾਂ ਨੇ ਉਹ ਚੱਲਦੀਆਂ ਰਹੀਆਂ ਹਨ ਇਹਨਾਂ ਦੀ ਸ਼ੁਰੂਆਤ ਜ਼ਿਆਦਾਤਰ ਤਾਂ ਜੈਤੋਂ ਦਾ ਜਦੋਂ ਮੋਰਚਾ ਲੱਗਿਆ ਉਸ ਤੋਂ ਇਹਨੇ ਆਜ਼ਾਦੀ ਦਾ ਬਿਗਲ ਵਜਾਇਆ ਸੀ ਜਿਦੋਂ ਮਹਾਰਾਜਾ ਰਪਦਮਣ ਸਿੰਘ ਨੂੰ ਨਾਭਾ ਦੀ ਰਿਆਸਤ ਤੋਂ ਥੱਲੇ ਅੰਗਰੇਜ਼ ਸਰਕਾਰ ਨੇ ਉਤਾਰਤਾ ਸੀ ਗੱਦੀ ਤੋਂ ਉਸ ਤੋਂ ਬਾਅਦ ਜੈਤੋਂ ਦਾ ਮੋਰਚਾ ਲੱਗਿਆ ਜਿਸ ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਵੀ ਆਏ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਬੱਬਰ ਅਕਾਲੀ ਲਹਿਰ ਚੱਲੀ ਉਹਨਾਂ ਨੇ ਸਾਰੇ ਮਹੰਤਾ ਤੋਂ ਗੁਰਦੁਆਰਾ ਸਾਹਿਬ ਸਨ ਜੋ ਅੰਗਰੇਜ਼ਾਂ ਨੇ ਉਹ ਕਾਬਜ ਕੀਤੇ ਹੋਏ ਸੀ ਮਹੰਤ ਓਥੇ ਬਿਠਾਏ ਹੋਏ ਸਨ ਉਹਨਾਂ ਤੋਂ ਸਾਰੇ ਉਹ ਆਜ਼ਾਦ ਕਰਾਏ ਉਸ ਤੋਂ ਬਾਅਦ ਸਰਦਾਰ ਭਗਤ ਸਿੰਘ ਜੋ ਹਨ ਉਹ ਤਾਂ ਕਮਾਲ ਦੀ ਮਤਲਬ ਉਹਨਾਂ ਨੇ ਆਪਣੀ ਮਹੱਤਵਪੂਰਨ ਰੋਲ ਅਦਾ ਕੀਤਾ ਉਹਨਾਂ ਦੀ ਸਾਰੀ ਟੀਮ ਨੇ ਜੋ ਉਹਨਾਂ ਦੇ ਨਾਲ ਹੁੰਦੇ ਸਨ ਸਰ ਕਰਤਾਰ ਸਿੰਘ ਸਰਾਭਾ ਜੀ ਹੋਏ ਹਨ ਅਤੇ ਇਹਨਾਂ ਸਾਰਿਆਂ ਨੇ ਰਲ ਕੇ ਬੜੀ ਲੰਬੀ ਲੜਾਈ ਲੜੀ ਅਤੇ ਸਾਨੂੰ ਆਜ਼ਾਦੀ ਦਵਾਈ